ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਸਥਾਨ ਹਨ ਜਿਨ ਜੈਸੇ ਸੈਲਾਨੀ ਆਕਰਸ਼ਨ ਹਨ ਜਿਵੇਂ ਕਿ ਗੱਲ ਕਰੀਏ ਤਾਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹਵੇਲੀ ਹਰਿਮੰਦਰ ਸਾਹਿਬ ਰੋਡ ਆਦਿ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਾ ਜਿਨ੍ਹਾਂ ਜਿਨ੍ਹਾਂ ਸਭ ਤੋਂ ਪਹਿਲੇ ਆਪਾਂ ਗੱਲ ਕਰੀਏ ਹਰਿਮੰਦਰ ਸਾਹਿਬ ਦੀ ਹਰਿਮੰਦਰ ਸਾਹਿਬ ਨੂੰ ਸਵਰਨ ਮੰਦਰ ਵੀ ਕਿਹਾ ਜਾਂਦਾ ਇਸ ਦੇ ਚਾਰ ਦਰਵਾਜ਼ੇ ਹਨ ਚਾਰ ਦਰਵਾਜ਼ਿਆਂ ਤੋਂ ਭਾਵ ਕਿ ਇਸ ਵਿੱਚ ਹਿੰਦੂ ਮੁਸਲਿਮ ਸਿੱਖ ਇਸਾਈ ਚਾਰੇ ਧਰਮਾਂ ਦੇ ਲੋਕ ਆ ਰਹੇ ਹੈ ਕਿਉਂਕਿ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਸਕਦੇ ਹਾਂ ਅਤੇ ਇੱਕ ਪੰਗਤ ਵਿੱਚ ਬੈਠ ਕੇ ਸਭ ਨੂੰ ਅਟੁੱਟ ਲੰਗਰ ਛਕਾਇਆ ਜਾਂਦਾ ਇੱਥੇ ਚੌਵੀ ਘੰਟੇ ਲੰਗਰ ਚੱਲਦਾ ਹੈ ਇੱਥੇ ਭੇਦ ਭਾਵ ਨਹੀਂ ਕੀਤਾ ਜਾਂਦਾ ਅਮੀਰ ਗਰੀਬ ਦਾ ਸਭ ਇੱਕੋ ਪੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਦਾ ਨਾਮ ਲੈ ਕੇ ਲੰਗਰ ਛਕਦੇ ਹਨ ਇਸ ਨੂੰ ਸੋਨੇ ਦਾ ਮੰਦਰ ਵੀ ਕਿਹਾ ਜਾਂਦਾ ਕਹਿੰਦੇ ਹਨ ਕਿ ਇੱਥੇ ਗੁਰੂ ਸਾਹਿਬ ਚੌਵੀ ਘੰਟੇ ਅੰਗ ਸੰਗ ਸਹਾਈ ਹੁਣ ਰਹਿੰਦੇ ਹਨ ਜਿਸ ਤਰ੍ਹਾਂ ਹੁਣ ਅਸੀਂ ਆਪਣੀ ਹਵੇਲੀ ਦੀ ਗੱਲ ਕਰੀਏ ਤਾਂ ਹਵੇਲੀ ਦੇ ਵਿੱਚ ਇਹ ਕਈ ਪ੍ਰਕਾਰ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹਨ ਇਸ ਵਿੱਚ ਸਾਡਾ ਵਿਰਸਾ ਸੰਭਾਲ ਕੇ ਰੱਖਿਆ ਹੈ ਜਿੱਦਾਂ ਮੈਂ ਗਿਆ ਸੀ ਹਵੇਲੀ ਦੇ ਵਿੱਚ ਅਤੇ ਉੱਥੇ ਕਈ ਪੁਰਾਣੀਆਂ ਮਟਕੇ ਹੋ ਜਿਵੇਂ ਮੰਜੇ ਮੰਜੇ ਪੱਖੀਆਂ ਜਿਹੜੀਆਂ ਉੱਨ ਨਾਲ ਬੰਨੀਆ ਬੁਣੀਆਂ ਹਨ ਕਈ ਮੂਰਤੀਆਂ ਜਨਾਨੀਆਂ ਪੰਜਾਬੀ ਔਰਤਾਂ ਦੀਆਂ ਰੱਖੀਆਂ ਹੋਈਆਂ ਹਨ ਅਤੇ ਇੱਥੇ ਖਾਣ ਵਿੱਚ ਜਿੱਦਾਂ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਮਿਲਦਾ ਹੈ ਜਿਹੜਾ ਕੀ ਬਹੁਤ ਮਸ਼ਹੂਰ ਹੈ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਇਹਨੂੰ ਅਜੇ ਤੱਕ ਉਹਨਾਂ ਨੇ ਸਾਂਭ ਕੇ ਰੱਖਿਆ ਹੈ ਇਹ ਇਹ ਸਾਨੂੰ ਅੰਦਰ ਵੜਦਿਆਂ ਹੀ ਮਿਲਦਾ ਹੈ ਖਾਣ ਨੂੰ ਇਸ ਪ੍ਰਕਾਰ ਸਾਡੀ ਹਵੇਲੀ ਵਿ ਦੇ ਵਿੱਚ ਸਾਡਾ ਪੰਜਾਬੀ ਵਿਰਸਾ ਸਾਂਭਿਆ ਹੋਇਆ ਹੈ ਧੰਨਵਾਦ ਜੀ